ਅੱਜ ਕੱਲ੍ਹ ਦੇਖਿਆ ਜਾਵੇ ਤਾਂ ਆਈ ਟੀ ਦਾ ਮਸ਼ੀਨੀ ਯੁੱਗ ਹੈ ਹਰ ਕੰਮ ਮਸ਼ੀਨੀ ਹੋ ਰਿਹਾ ਹੈ ਅੱਜ ਕੱਲ੍ਹ ਹਰ ਇੱਕ ਚੀਜ਼ ਔਨਲਾਈਨ ਮੁਹੱਈਆ ਹੋ ਰਹੀ ਹੈ ਵੱਧਦੀ ਹੋਈ ਇੰਟਰਨੈੱਟ ਦੀ ਸਹੂਲਤ ਹੂੰ ਉਦਯੋਗਿਕ ਵਧਾਇਆ ਜਾ ਰਿਹਾ ਹੈ ਇੰਟਰਨੈੱਟ ਦੇ ਹਰ ਇੱਕ ਕੰਮ ਮੁਹੱਈਆ ਕੀਤਾ ਜਾਂਦਾ ਹੈ ਇੰਟਰਨੈੱਟ ਦੀ ਵਿੱਤੀ ਖੇਤਰ ਵਿੱਚ ਇਸ ਤਰ੍ਹਾਂ ਬਦਲ ਬਦਲਾਉ ਕੀਤਾ ਹੈ ਕਿ ਅਸੀਂ ਘਰ ਬੈਠੇ ਹੀ ਪੈਸੇ ਇੱਧਰ ਉੱਧਰ ਟਰਾਂਸਫਰ ਕਰ ਸਕਦੇ ਹਾਂ ਕਹਿਣਾ ਹੈ ਕਿ ਭਾਵ ਵਿੱਤੀ ਲੈਣ ਲਈ ਵੀ ਸਾਨੂੰ ਡਿਜੀਟਲ